ਹਾਂਜੀ ਜੇਕਰ ਸ਼ਹਿਰੀ ਖੇਤਰਾਂ ਵਿੱਚ ਜੋ ਲੋਕ ਖੇਡਾਂ ਖੇਡਦੇ ਹਨ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰੀ ਲੋਕ ਜ਼ਿਆਦਾਤਰ ਇਨਡੋਰ ਗੇਮਾਂ ਜ਼ਿਆਦਾ ਖੇਲਦੇ ਹਨ ਮਤਲਬ ਆਪਣੇ ਘਰ ਦੇ ਨਾਲ ਸੰਬੰਧਿਤ ਖੇਡਾਂ ਹੀ ਖੇਡਦੇ ਹਨ ਅਤੇ ਜੋ ਪੇਂਡੂ ਖੇਤਰ ਨਾਲ ਸੰਬੰਧਿਤ ਲੋਕ ਹਨ ਉਹ ਜ਼ਿਆਦਾਤਰ ਆਊਟਡੋਰ ਗੇਮਸ ਜ਼ਿਆਦਾ ਖੇਲਦੇ ਹਨ ਅਤੇ ਪੇਂਡੂ ਲੋਕ ਕ੍ਰਿਕਟ ਕਬੱਡੀ ਕੁਸ਼ਤੀ ਆਦਿ ਖੇਲਦੇ ਹਨ ਜਦ ਕਿ ਦੂਜੇ ਪਾਸੇ ਸ਼ਹਿਰੀ ਲੋਕ ਘਰ ਵਿੱਚ ਹੀ ਰਹਿ ਕੇ ਜਾਂ ਆਪਣੀ ਪਾਰਕ ਨਾਲ਼ ਸੰਬੰਧਿਤ ਗੇਮਾਂ ਖੇਡਦੇ ਹਨ